ਅੱਜ ਦੇ ਸਮੇਂ ਵਿੱਚ ਰੋਡ ਐਕਸੀਡੈਂਟ ਵੀ ਬਹੁਤ ਵੱਧ ਰਹੇ ਹਨ ਅਤੇ ਬਿਮਾਰੀਆਂ ਵੀ ਬਹੁਤ ਵੱਧ ਰਹੀਆਂ ਹਨ ਅਤੇ ਜਿਸ ਕਾਰਨ ਰੋਡ ਐਕਸੀਡੈਂਟ ਬਹੁਤ ਹੁੰਦੇ ਹਨ ਅਤੇ ਬਹੁਤ ਜਾਨਾਂ ਗਵਾਈਆਂ ਜਾਂਦੀਆਂ ਹਨ ਅਤੇ ਜਿਸ ਕਰਕੇ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਸਾਨੂੰ ਆਪਣਾ ਲਾਈਫ਼ ਇਨਸ਼ੋਰੈਂਸ ਕਰਾਉਣਾ ਚਾਹੀਦਾ ਹੈ ਜਿਸ ਨੂੰ ਕਿ ਅਸੀਂ ਬੀਮਾ ਕਹਿੰਦੇ ਹਾਂ ਅਤੇ ਹਰੇਕ ਇੱਕ ਨੂੰ ਆਪਣਾ ਬੀਮਾ ਕਰਵਾ ਲੈਣਾ ਚਾਹੀਦਾ ਹੈ ਕਿ ਜਦੋਂ ਵੀ ਆਪਣਾ ਕੋਈ ਵੀ ਐਕਸੀਡੈਂਟ ਹੁੰਦਾ ਹੈ ਕਿਸੇ ਵੀ ਚੀਜ਼ ਨਾਲ ਅਤੇ ਜਦੋਂ ਵੀ ਅਸੀਂ ਹੋਸਪੀਟਲ 'ਚ ਜਾਂਦੇ ਹਾਂ ਤਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਜੁੜ ਪੈਣ ਜੁੜਦੇ ਜਿਸ ਕਾਰਨ ਵੀ ਅਸੀਂ ਆਪਣਾ ਇਲਾਜ ਕਰਵਾ ਸਕੀਏ ਅਤੇ ਜਿਸ ਕਾਰਨ ਸਾਨੂੰ ਜਾਨ ਵੀ ਗਵਾਉਣੀ ਪੈਂਦੀ ਹੈ ਅਤੇ ਸਾਨੂੰ ਜਦੋਂ ਸਾਡੇ ਕੋਲ ਇੰਸ਼ੋਰੈਂਸ ਹੋਵੇਗਾ ਅਤੇ ਲਾਈਫ਼ ਇਕ ਇਨਸ਼ੋਰੈਂਸ ਵਾਲੀਆਂ ਕੰਪਨੀਆਂ ਸਾਨੂੰ ਬਹੁਤ ਹੱਦ ਤੱਕ ਸਾਡੀ ਮਦਦ ਕਰਦੀਆਂ ਹਨ ਅਤੇ ਸਾਨੂੰ ਬਹੁਤ ਹੀ ਜ਼ਿਆਦਾ ਨਹੀਂ ਪਰ ਹੱਦ ਬਹੁਤ ਹੱਦ ਤੱਕ ਸਾਨੂੰ ਇਹ ਪੈਸੇ ਦੇ ਦਿੰਦੀਆਂ ਹਨ ਜਿਸ ਕਰਕੇ ਹੀ ਸਾਡਾ ਬਹੁਤ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ ਅਤੇ ਸਾਡੀ ਜਾਨ ਵੀ ਬਚ ਜਾਂਦੀ ਹੈ ਅਤੇ ਹੋਸਪੀਟਲਾਂ ਵਿੱਚ ਇਲਾਜ ਵੀ ਬਹੁਤ ਮਹਿੰਗਾ ਹੈ ਜਿਸ ਨੂੰ ਅਸੀਂ ਅਫੋਰਡ ਨਹੀਂ ਕਰ ਪਾਉਂਦੇ ਅਤੇ ਜਿਸ ਕਰਕੇ ਸਾਨੂੰ ਲਾਈਫ਼ ਇੰਸ਼ੋਰੈਂਸ ਕਰਵਾ ਲੈਣਾ ਚਾਹੀਦਾ ਹੈ ਇਸਦੇ ਬਹੁਤ ਫਾਇਦੇ ਹਨ ਅਤੇ ਇਸ ਇਹ ਬਹੁਤ ਇੱਕ ਚੰਗੀ ਪੋਲਿਸੀ ਹੈ